ਗੁਡ ਆਫਟਰਨੂਨ ਸਰ ਹਾਂ ਤੁਸੀਂ ਰੋਹਿਤ ਦੇ ਪਾਪਾ ਗੱਲ ਕਰ ਰਹੇ ਹੋ ਅਸੀਂ ਰੋਹਿਤ ਦੇ ਸਕੂਲ ਤੋਂ ਗੱਲ ਕਰ ਰਹੇ ਹਾਂ ਹਾਂਜੀ ਬੱਚੇ ਦੀ ਬੱਚੇ ਦੀ ਬੱਚੇ ਦਾ ਰਿਕਾਰਡ ਦੇਣਾ ਸੀ ਤੁਹਾਨੂੰ ਜੋ ਟੈਸਟ ਹੁੰਦੇ ਰਹਿੰਦੇ ਕਲਾਸ 'ਚ ਹਾਂਜੀ ਤੁਹਾਡੇ ਮਤਲਬ ਬੱਚੇ ਦੇ ਜੋ ਟੈਸਟ ਯੂਨਿਟ ਟੈਸਟ ਹੋਏ ਸੀ ਇਸੀ ਲਾਸਟ ਮੰਥ ਹੋਏ ਸੀ ਤਾਂ ਹਾਂਜੀ ਉਹਦੀ ਟੈਸਟ ਰਿਪੋਰਟ ਬਾਰੇ ਤੁਹਾਡੇ ਨਾਲ ਗੱਲ ਕਰਨੀ ਸੀ ਹਾਂਜੀ ਐਕਚੁਲੀ ਪਹਿਲਾਂ ਪੀ ਟੀ ਐੱਮ ਕਰਨੀ ਸੀ ਬਟ ਕੋਈ ਇਸ਼ੂ ਦੇ ਕਾਰਨ ਪੀ ਟੀ ਐੱਮ ਕੈਂਸਲ ਕਰਤੀ ਇਸ ਲਈ ਤੁਹਾਨੂੰ ਅਸੀਂ ਕਾਲ ਕਰ ਰਹੇ ਹਾਂ

ਅਤੇ ਜਿੱਦਾਂ ਕਿ ਤੁਹਾਨੂੰ ਪਤਾ ਅ ਰੋਹਿਤ ਥੋੜ੍ਹਾ ਜਿਹਾ ਧਿਆਨ ਘੱਟ ਦਿੰਦਾ ਟੈਸਟ ਵਗੈਰਾ ਦੇ ਵਿੱਚ ਵੀ ਨਹੀਂ ਪੜ੍ਹਦਾ ਨੰਬਰ ਵੀ ਇਸ ਵਾਰ ਥੋੜ੍ਹੇ ਜਿਹੇ ਘੱਟ ਆਏ ਆ ਬੱਚੇ ਨੇ ਮਿਹਨਤ ਨਹੀਂ ਕੀਤੀ ਘਰ ਅੱਛਾ ਅਤੇ ਜਿੱਦਾਂ ਕਿ ਬੱਚੇ ਦਾ ਤੁਸੀਂ ਟਿਊਸ਼ਨ ਵਗੈਰਾ ਤਾਂ ਨਹੀਂ ਰਖਵਾਇਆ ਕਿਤੇ ਵੈਸੇ ਦੇਖ ਵੈਸੇ ਵੈਸੇ ਦੇਖੋ ਟਿਊਸ਼ਨ ਦੀ ਜ਼ਰੂਰਤ ਹੈ ਨਹੀਂ ਕਿਉਂਕਿ ਜੋ ਕੰਮ ਅਸੀਂ ਸਕੂਲ ਦੇ ਵਿੱਚ ਕਰਵਾਉਂਦੇ ਹਾਂ ਬੱਚਾ ਜੇ ਉਹੀ ਕਰ ਲਵੇ ਤਾਂ ਤੁਹਾਨੂੰ ਪਤਾ ਕਿ ਜ਼ਿਆਦਾ ਟਿਊਸ਼ਨ ਦੀ ਲੋੜ ਪੈਂਦੀ ਨਹੀਂ ਹੈ ਹਾਂਜੀ ਜਿੱਦਾਂ ਕਿ ਤੁਹਾਨੂੰ ਬਾਕੀ ਮੈਂ ਤੁਹਾਨੂੰ ਸਬਜੈਕਟ ਦੇ ਨੰਬਰ ਦੱਸ ਦਿੰਦਾ ਕਿੱਦਾਂ ਕਿੱਦਾਂ ਨੰਬਰ ਆਏ ਨੇ ਕਿਹੜੇ ਕਿਹੜੇ ਸਬਜੈਕਟ 'ਚੋਂ ਜ਼ਿਆਦਾ ਵੀਕ ਹੈ ਹਾਂਜੀ ਮੈਂ ਦੱਸਦਾ ਤੁਹਾਨੂੰ ਜਿੱਦਾਂ ਕਿ ਪੰਜਾਬੀ ਦੇ ਵਿੱਚ ਤਾਂ ਠੀਕ ਹੈ ਪੰਜਾਬੀ ਕਰ ਲੈਂਦਾ ਬਟ ਗਲਤੀਆਂ ਬਹੁਤ ਕਰਦਾ ਲਿਖਣ ਦੇ ਵਿੱਚ ਹਾਂਜੀ ਲਿਖਣ 'ਚ ਗਲਤੀਆਂ ਕਰਦਾ ਬਾਕੀ ਹਿੰਦੀ ਦੇ ਵਿੱਚ ਤਾਂ ਬਿਲਕੁਲ ਲੋਅ ਹੈ ਹਾਂਜੀ ਹਿੰਦੀ 'ਚ ਅੱਛਾ ਜੀ ਹਿੰਦੀ ਦੇ ਵਿੱਚ ਲੋਅ ਹੈ ਹਾਂਜੀ ਜਿੱਦਾਂ ਮੈਥ ਹੋ ਗਿਆ ਮੈਥ ਦੇ ਵਿੱਚ ਸਾਰਾ ਸਹੀ ਕਰ ਲੈਂਦਾ ਬਟ ਥੋੜ੍ਹੀ ਜਿਹੀ ਜਲਦਬਾਜ਼ੀ ਕਰ ਦਿੰਦਾ ਆ ਲਿਖਣ ਦੇ ਵਿੱਚ ਹਾਂਜੀ ਤੁਹਾਨੂੰ ਪਤਾ ਮੈਥ ਸਬਜੈਕਟ ਥੋੜ੍ਹਾ ਜਿਹਾ ਟਫ ਹੁੰਦਾ ਥੋੜ੍ਹਾ ਜਿਹਾ ਇਸ 'ਤੇ ਜ਼ਿਆਦਾ ਧਿਆਨ ਦੇਣਾ ਪਏਗਾ ਉਹਨੂੰ ਮੈਥ 'ਤੇ ਹਾਂਜੀ ਬਾਕੀ ਹਾਂਜੀ ਬਾਕੀ ਜਿਹੜਾ ਇੰਗਲਿਸ਼ ਹੋ ਗਿਆ ਇੰਗਲਿਸ਼ ਦੇ ਵਿੱਚ ਵੀ ਐਵਰੇਜ ਮਤਲਬ ਥੋੜ ਮਿਹਨਤ ਕਰਦਾ ਥੋੜ੍ਹੀ ਜਿਹੀ ਹੋਰ ਮਿਹਨਤ ਦੀ ਜ਼ਰੂਰਤ ਹੈ ਪਰ ਹਾਂਜੀ ਅਤੇ ਘਰ ਕਿੱਦਾਂ ਪੜ੍ਹਦਾ ਹੈ ਰੋਹਿਤ ਅੱਛਾ ਜੀ ਮਤਲਬ ਘਰ ਵੀ ਜ਼ਿਆਦਾ ਨਹੀਂ ਪੜ੍ਹਦਾ ਹਾਂਜੀ ਜਿੱਦਾਂ ਕਿ ਤੁਹਾਨੂੰ ਪਤਾ ਹਜੇ ਤਾਂ ਫਸਟ ਟੈਸਟ ਹੋਇਆ ਸੀ ਅਤੇ ਅੱਗੇ ਅੱਗੇ ਟੈਸਟ ਹੋਣਗੇ ਅਤੇ ਦਿੱਕਤ ਆਏਗੀ ਬੱਚੇ ਨੂੰ ਹਾਂਜੀ ਥੋੜ੍ਹਾ ਜਿਹਾ ਬੱਚੇ 'ਤੇ ਧਿਆਨ ਦਿਓ ਠੀਕ ਹੈ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ